ਭਾਰਤ ਇੱਕ ਵੱਖ ਵੱਖ ਰਾਜਾਂ ਦਾ ਦੇਸ਼ ਹੈ ਦੇਸ਼ਾਂ ਦੇ ਨਾਲ ਨਾਲ ਉਹਨਾਂ ਦੇ ਕੱਪੜੇ ਲੀੜੇ ਪਾਉਣ ਦਾ ਪਹਿਰਾਵੇ ਦਾ ਰੰਗ ਢੰਗ ਰਹਿਣ ਸਹਿਣ ਦਾ ਵੀ ਵੱਖਰਾ ਹੈ ਇਸ ਤਰ੍ਹਾਂ ਪੱਛਮੀ ਫੈਸ਼ਨ ਨੇ ਭਾਰਤ ਵਿੱਚ ਬਹੁਤ ਹੀ ਮਾੜਾ ਅਸਰ ਪਾਇਆ ਹੈ ਜਿਵੇਂ ਜਿਵੇਂ ਫੈਸ਼ਨ ਵੀਕ ਵੱਧਦਾ ਜਾਂਦਾ ਉਸੇ ਤਰ੍ਹਾਂ ਕੱਪੜੇ ਘੱਟਦੇ ਜਾਂਦੇ ਹਨ ਕੱਪੜੇ ਘੱਟਣ ਦੇ ਕਾਰਨ ਇੱਜ਼ਤ ਦਾ ਜਨਾਜਾ ਕੱਢਿਆ ਜਾਂਦਾ ਹੈ ਇਹ ਸਾਰਿਆਂ ਨੂੰ ਛੱਡ ਕੇ ਇੱਕ ਪੰਜਾਬ ਅਜਿਹਾ ਹੈ ਜਿੱਥੇ ਪੰਜਾਬੀ ਸੱਭਿਅਤਾ ਨੂੰ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਕੇ ਐਨ ਪੰਜਾਬੀ ਪਹਿਰਾਵੇ ਵਿੱਚ ਰਹਿ ਕੇ ਦੂਰੋਂ ਵੀ ਇੱਕ ਅਲੱਗ ਪੰਜਾਬੀ ਦੀ ਪਹਿਚਾਣ ਹੁੰਦੀ ਹੈ ਕੁੜਤਾ ਪਜਾਮਾ ਸਾਦਗੀ ਹੈ ਮਤਲਬ ਜੇ ਪੰਜਾਬ ਵਿੱਚ ਕੋਈ ਵੀ ਆਪਾਂ ਕਿਤੇ ਵੀ ਜਾਣਾ ਤੁਹਾਨੂੰ ਪੰਜਾਬੀ ਬੰਦੇ ਦੀ ਅਲੱਗ ਹੀ ਪਹਿਰਾਵਾ ਅਤੇ ਅਲੱਗ ਹੀ ਉਹਦੀ ਟੌਰ ਟ ਟੱਪਾ ਲੱਗ ਰ ਰਹੇਗਾ ਹੁਣ ਤਾਂ ਕੱਪੜਿਆਂ ਦੇ ਨਾਲ ਨਾਲ ਲੋਕ ਜਿਹੜੇ ਫੈਸ਼ਨ ਵੀਕ ਵੀ ਹੋਣ ਲੱਗ ਗਏ ਜਾਂ ਫੈਸ਼ਨ ਸ਼ੋਅ ਵੀ ਹੋਣ ਲੱਗ ਗਏ ਉੱਥੇ ਇਹੋ ਜਿਹਾ ਜਲੂਸ ਕੱਢਿਆ ਜਾਂਦਾ ਹੈ ਲੇਕਿਨ ਜਿੱਥੇ ਪੰਜਾਬੀ ਪਹਿਰਾਵਾ ਅਤੇ ਬੰਦੇ ਦੇ ਗੁਰਸਿੱਖ ਬਾਣ ਵਾਲਾ ਹੋਵੇ ਸਰਦਾਰ ਹੋਵੇ ਪੱਗ ਬੰਨੀ ਹੋਵੇ ਉਹ ਤੁਹਾਨੂੰ ਸੌ ਕੋਹ ਤੋਂ ਵੀ ਪਖਾ ਪਛਾਣਿਆ ਜਾਵੇਗਾ